ਮੈਂ ਜੁਗਰਾਜ ਸਿੰਘ ਐਮਾਜ਼ੋਨ ਤੋਂ ਰੀਸੈਂਟਲੀ ਇੱਕ ਪ੍ਰੋਡਕਟ ਔਡਰ ਕੀਤਾ ਸੀ ਮੋਬਾਈਲ ਫ਼ੋਨ ਔਡਰ ਕੀਤਾ ਸੀ ਮੋਬਾਈਲ ਫ਼ੋਨ ਅੋਪੋ ਕੰਪਨੀ ਦਾ ਸੀ ਐਫ ਸਤਾਰਾਂ ਮੌਡਲ ਅਤੇ ਜਿਹਦੀ ਕੀਮਤ ਵੀਹ ਹਜ਼ਾਰ ਰੁਪਏ ਸੀ ਵੀਹ ਦਿਨ ਪਹਿਲਾਂ ਔਡਰ ਕੀਤਾ ਸੀ ਅਤੇ ਕੱਲ੍ਹ ਡਿਲੀਵਰ ਹੋਇਆ ਅਨਬੋਕਸਿੰਗ ਕਰਨ ਤੋਂ ਬਾਅਦ ਮੈਂ ਦੇਖਿਆ ਕਿ ਮੋਬਾਈਲ ਫ਼ੋਨ ਉਸ ਕੰਡੀਸ਼ਨ 'ਚ ਨਹੀਂ ਸੀ ਜਿਸ ਕੰਡੀਸ਼ਨ 'ਚ ਦਿਖਾਇਆ ਗਿਆ ਸੀ ਐਪ 'ਤੇ ਐਮਾਜ਼ਨ ਐਪ 'ਤੇ ਜਦ ਕਿ ਮੈਂ ਬਲੈਕ ਕਲਰ ਔਡਰ ਕੀਤਾ ਸੀ ਅਤੇ ਮੈਨੂੰ ਡਿਲੀਵਰ ਵਾਈਟ ਕਲਰ ਦਾ ਹੋਇਆ ਅਤੇ ਅਨਬੋਕਸਿੰਗ ਤੋਂ ਬਾਅਦ ਜਦੋਂ ਮੈਂ ਔਨ ਕੀਤਾ ਫ਼ੋਨ ਔਨ ਵੀ ਕਈ ਦੋ ਤਿੰਨ ਵਾਰ ਕਰਨ ਤੋਂ ਬਾਅਦ ਵੀ ਔਨ ਨਹੀਂ ਹੋਇਆ ਅਤੇ ਜਦੋਂ ਕਈ ਵਾਰ ਟਰਾਈ ਕਰਨ ਤੋਂ ਬਾਅਦ ਔਨ ਹੋਇਆ ਤਾਂ ਉਹਦਾ ਔਪਰੇਟਿੰਗ ਸਿਸਟਮ ਚੰਗੀ ਤਰ੍ਹਾਂ ਵਰਕ ਨਹੀਂ ਸੀ ਕਰ ਰਿਹਾ ਅਤੇ ਕੋਈ ਵੀ ਐਪ ਚੰਗੀ ਤਰ੍ਹਾਂ ਨਹੀਂ ਸੀ ਕੰਮ ਕਰ ਰਿਹਾ ਅਤੇ ਟੌਟਲ ਡਿਸਅਪੋਇੰਟਮੈਂਟ ਸੀ ਮੇਰੇ ਲਈ ਉਹ ਕਿਉਂਕਿ ਮੈਂ ਪਹਿਲਾਂ ਵੀ ਇਸ ਐਪ ਐਪ ਤੋਂ ਐਮਾਜੌਨ ਐਪ ਤੋਂ ਕਈ ਵਾਰ ਔਡਰ ਕੀਤਾ ਆ ਤੇ ਕਾਫ਼ੀ ਵਧੀਆ ਪ੍ਰੋਡਕਟ ਮੈਨੂੰ ਡਿਲੀਵਰ ਹੋਏ ਆ ਅਤੇ ਪੋਜ਼ੀਟਿਵ ਰੀਵਿਊ ਸੀ ਮੇਰਾ ਇਸ ਪਰ ਇਸ ਵਾ ਪਹਿਲੀ ਵਾਰ ਮੈਨੂੰ ਇਹ ਇੱਦਾਂ ਦਾ ਪ੍ਰੋਡਕਟ ਹੋਇਆ ਜਿਸ 'ਚ ਮੈਨੂੰ ਡਿੰਸਅਪੋਇੰਟਮੈਂਟ ਦੇਖਣ ਨੂੰ ਮਿਲੀ ਹੈ ਅਤੇ ਮੈ ਇਸ ਕਰਕੇ ਮੈਨੂੰ ਆਪਣੇ ਏ ਪੈਸੇ ਵੀ ਵੇਸਟ ਵੇਸਟ ਲੱਗੇ ਕਰਨੇ ਅਤੇ ਮੈਂ ਚਾਹੁੰਦਾ ਕਿ ਹੁਣ ਇਹ ਪ੍ਰੋਡਕਟ ਨੂੰ ਰੀਪਲੇਸ ਕੀਤਾ ਜਾਵੇ ਜਾਂ ਵਾਪਸ ਕੀਤਾ ਜਾਵੇ ਮੈਨੂੰ ਮੇਰੇ ਪੈਸੇ ਵਾਪਸ ਦਿੱਤੇ ਜਾਣ ਥੈਂਕ ਯੂ